ਮੈਂ ਆਪਣੀ ਗਾਇਕੀ ਨੂੰ ਜਾਂ ਸਿੰਗਿੰਗ ਨੂੰ ਪ੍ਰਦਰਸ਼ਨ ਕਰਨ ਲਈ ਜਾਂ ਉਸ ਨੂੰ ਲਿਖਣ ਲਈ ਬਹੁਤ ਸਾਰੇ ਗਾਇਕਾਂ ਨੂੰ ਸੁਣਦੀ ਹਾਂ ਜਿਹਦੇ ਕਰਕੇ ਮੈਨੂੰ ਹੋਰ ਜ਼ਿਆਦਾ ਆਪਣੀ ਗਾਇਕੀ ਵਿੱਚ ਮਦਦ ਮਿਲਦੀ ਹੈ ਕਿ ਉਸ ਵਿੱਚ ਕਿਵੇਂ ਕੀ ਚੀਜ਼ ਸ਼ਾਮਿਲ ਕਰਨੀ ਹੈ ਤਾਂ ਕਿ ਮੈਂ ਲੋਕਾਂ ਨੂੰ ਪ੍ਰੋਤਸਾਹਿਤ ਕਰ ਸਕਾਂ ਅਗਰ ਮੈਂ ਜਿੰਨਾ ਜ਼ਿਆਦਾ ਆਪਣੇ ਗਾਇਕਾਂ ਨੂੰ ਜਾਂ ਨਾਵਲਾਂ ਨੂੰ ਬੁਕਸ ਨੂੰ ਪੜ੍ਹਾਂਗੀ ਉਨਾ ਹੀ ਜ਼ਿਆਦਾ ਮੈਂ ਆਪਣੀ ਗਾਇਕੀ ਵਿੱਚ ਆਪਣੇ ਸ਼ੁੱਧ ਸ਼ਬਦਾਂ ਨੂੰ ਸ਼ਾਮਿਲ ਕਰ ਸਕਾਂਗੀ ਅਤੇ ਇਸ ਨਾਲ ਮੈਂ ਆਪਣੀ ਗਾਇਕੀ ਨਾਲ ਲੋਕਾਂ ਨੂੰ ਹੋਰ ਜ਼ਿਆਦਾ ਸੱਚੇ ਰਸਤੇ ਸਾਫ ਰਸਤੇ ਪਾ ਸਕਾਂਗੀ ਮੈਂ ਗਾਇਕਾਂ ਨੂੰ ਸੁਣਦੀ ਹਾਂ ਅਤੇ ਬਹੁਤ ਧਿਆਨ ਨਾਲ ਸੁਣਦੀ ਹਾਂ ਜਿਸ ਕਰਕੇ ਮੈਨੂੰ ਅਤੇ ਲੋਕਾਂ ਨੂੰ ਮੇਰੇ ਗਾਣਿਆਂ ਨੂੰ ਸੁਣਨ ਨਾਲ ਇੱਕ ਮਨ ਨੂੰ ਸ਼ਾਂਤੀ ਮਿਲ ਸਕੇ ਅਤੇ ਬਹੁਤ ਸਾਰੀਆਂ ਬੁਕਸ ਪੜ੍ਹਨ ਤੋਂ ਬਾਅਦ ਹੀ ਮੈਂ ਕੁਛ ਚੀਜ਼ਾਂ ਲਿਖਦੀ ਹਾਂ ਅਤੇ ਉਹਨਾਂ ਨੂੰ ਗਾਣਿਆਂ ਵਿੱਚ ਵਿਆਖਿਆ ਕਰਦੀ ਹਾਂ